ਮੈਨੂੰ ਘੁੰਮਣਾ ਫਿਰਨਾ ਇਸ ਲਈ ਪਸੰਦ ਹੈ ਇਸ ਕਿਉਂਕਿ ਇਸ ਕਰ ਇਸ ਨਾਲ ਮੈਂ ਦੁਨੀਆ ਨੂੰ ਜਾਣ ਸਕਦੀ ਹਾਂ ਲੋਕਾਂ ਦੇ ਅਲੱਗ ਅਲੱਗ ਜਿਹੜੇ ਰੀਤੀ ਰਿਵਾਜ਼ ਹੁੰਦੇ ਨੇ ਜਿਹੜੇ ਇਤਿਹਾਸਿਕ ਸਥਾਨਾਂ 'ਤੇ ਇਤਿਹਾਸ ਹੁੰਦੇ ਨੇ ਉਹਨਾਂ ਨੂੰ ਜਾਨਣ ਦਾ ਮੈਨੂੰ ਸ਼ੌਂਕ ਹੈ ਇਸ ਕਰਕੇ ਮੈਨੂੰ ਦੁਨੀਆ ਨੂੰ ਐਕਸਪਲੋਰ ਕਰਨਾ ਜਾਨਣਾ ਬਹੁਤ ਹੀ ਵਧੀਆ ਲੱਗਦਾ ਕੁਛ ਸਮੇਂ ਪਹਿਲੇ ਮੈਂ ਅਨੰਦਪੁਰ ਸਾਹਿਬ ਮੈਂ ਮਨੀਕਰਨ ਸਾਹਿਬ ਹੇਮਕੁੰਟ ਸਾਹਿਬ ਗਈ ਸੀ ਅਤੇ ਮੈਨੂੰ ਉਹ ਹੇਮਕੁੰਟ ਸਾਹਿਬ ਦਾ ਮਤਲਬ ਸਫ਼ਰ ਜੋ ਸੀ ਬਹੁਤ ਵਧੀਆ ਲੱਗਾ ਸੀ ਕਿਉਂਕਿ ਇੱਕ ਤੋਂ ਉਹ ਪਹਾੜਾਂ 'ਚ ਸੀ ਅਤੇ ਪਹਾੜਾਂ ਦਾ ਵਾਤਾਵਰਨ ਕਾਫੀ ਵਧੀਆ ਹੁੰਦਾ ਹੈ ਜਿਸ ਕਰਕੇ ਮੈਨੂੰ ਉਹ ਉੱਥੇ ਜਾਣਾ ਬਹੁਤ ਵਧੀਆ ਲੱਗਾ ਮਨੀਕਰਨ ਸਾਹਿਬ ਦਾ ਇਤਿਹਾਸ ਵੀ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਸੀ ਅਨੰਦਪੁਰ ਸਾਹਿਬ ਹੋਲਾ ਮੁਹੱਲਾ ਦਾ ਜਿਹੜਾ ਪਰਬ ਸੀ ਉੱਥੇ ਮੈਂ ਗਈ ਸੀ ਲੋ ਹੋਲੀਆ 'ਚ ਜਿਸ ਕਰਕੇ ਉੱਥੇ ਬਹੁਤ ਵਧੀਆ ਲੱਗਾ ਸੀ ਅਤੇ ਮੈਨੂੰ ਪਹੁਵਨ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ ਉੱਥੇ ਅਸੀਂ ਪਿਛਲੇ ਐਤਵਾਰ ਗਏ ਸੀ ਅਤੇ ਰਸਤੇ 'ਚ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਂਦੇ ਸੀ ਉੱਥੇ ਵੀ ਆਪਾਂ ਜਾ ਕੇ ਮੱਥਾ ਟੇਕਿਆ ਅਤੇ ਉਹਨਾਂ ਦਾ ਵਾ ਅਤੇ ਇਸ ਕਰਕੇ ਇਹ ਹੈ ਮੈਨੂੰ ਘੁੰਮਣਾ ਫਿਰਨਾ ਤਾਂ ਪਸੰਦ ਹੈ ਬਟ ਜੇ ਅਸੀਂ ਘੁੰਮਣਾ ਫਿਰਨ ਦੇ ਨਾਮ 'ਤੇ ਜੋ ਯਾਤਰਾਵਾਂ ਕਰਦੇ ਹਾਂ ਤਾਂ ਇਸ ਨਾਲ ਸਾਡੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਅਤੇ ਸਾਡੇ ਸਾਨੂੰ ਉਦੋਂ ਸਾਡੇ ਸ਼ਹੀਦਾਂ ਦਾ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਜਾਨਣ ਦਾ ਵੀ ਮੌਕਾ ਮਿਲਦਾ ਹੈ ਇਸ ਕਰਕੇ ਮੈਨੂੰ ਘੁੰਮਣਾ ਫਿਰਨਾ ਵੀ ਪਸੰਦ ਹੈ ਅਤੇ ਯਾਤ ਯਾਤਰਾਵਾਂ ਕਰਨੀਆਂ ਵੀ ਪਸੰਦ ਹੈ ਮੈਂ ਆਪਣੇ ਘਰਦਿਆਂ ਦੇ ਨਾਲ ਹੋਰ ਵੀ ਕਈ ਯਾਤਰਾਵਾਂ 'ਤੇ ਜਾਣਾ ਚਾਹੁੰਦੀ ਹਾਂ ਜਿਵੇਂ ਹਿੰਦੂ ਧਰਮ ਦੀ ਯਾਤਰਾਵਾਂ ਹੋ ਗਈਆਂ ਕਾਸ਼ੀ ਜਗਨਨਾਥ ਔਰ ਮੈਂ ਹਰੀਦੁਆਰ ਵੀ ਗਈ ਸ ਹਰਦੀਦੁਆਰ ਹਰੀਦੁਆਰ ਵਿੱਚ ਜਾ ਚੁੱਕੀ ਹਾਂ ਜਿੱਥੇ ਗੰਗਾ 'ਚ ਇਸ਼ਨਾਨ ਕੀਤਾ ਸੀ ਰਿਸ਼ੀਕੇਸ਼ ਸਾਹਿਬ ਗੁਰਦੁਆਰਾ 'ਚ ਵੀ ਗਈ ਹਾਂ

ਹੋਰ ਵੀ ਕਈ ਸਥਾਨਤਕ ਇਸ ਤੋਂ ਬਾਅਦ ਮੈਂ